ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੈਬ ਵਾਲੇ ਰਮੇਸ਼ ਜੀ ਬੋਲ ਰਹੇ ਹੋ ਮੇਰਾ ਨਾਮ ਜੈਸਮੀਨ ਮੈਂ ਕੱਲ੍ਹ ਸਵੇਰੇ ਇੱਕ ਕੈਬ ਬੁੱਕ ਕੀਤੀ ਸੀ ਨਵਾਂਸ਼ਹਿਰ ਤੋਂ ਦਿੱਲੀ ਏਅਰਪੋਰਟ ਲਈ ਪਰ ਮੈਂ ਉਹ ਰਾਤੀਂ ਰੱਦ ਕਰ ਦਿੱਤੀ ਹਾਂਜੀ ਕਿਉਂਕਿ ਉਹ ਮੇਰੇ ਬ੍ਰਦਰ ਦੀ ਰਾਤੀ ਥੋੜ੍ਹੀ ਤਬੀਅਤ ਖ਼ਰਾਬ ਹੋ ਗਈ ਸੀਗੀ ਅਤੇ ਇਸ ਲਈ ਸਾਨੂੰ ਉਹਨੂੰ ਹੋਸਪੀਟਲ ਲੈ ਕੇ ਜਾਣਾ ਪਿਆ ਜਿਹਦੇ ਕਰਕੇ ਮੈਂ ਆਪਣੀ ਜਿਹੜੀ ਫਲਾਈਟ ਹੈ ਉਹ ਵੀ ਡੀਲੇਅ ਕਰ ਦਿੱਤੀ ਦੋ ਤਿੰਨ ਦਿਨਾਂ ਲਈ ਹਾਂਜੀ ਅਤੇ ਮੈਂ ਨਾ ਜਿਹੜੀ ਕੈਬ ਬੁੱਕ ਕੀਤੀ ਸੀ ਇਹਦੀ ਪੇਮੈਂਟ ਵੀ ਅਡਵਾਂਸ ਹੀ ਕਰ ਦਿੱਤੀ ਸੀ ਗੂਗਲ ਪੇ ਦੇ ਥਰੂਅ ਹਾਂਜੀ ਅਤੇ ਮੈਂ ਹੁਣ ਚਾਹੁੰਦੀ ਹਾਂ ਕਿ ਤੁਸੀਂ ਮੇਰੀ ਇਹ ਜਿਹੜੀ ਪੇਮੈਂਟ ਹੈ ਤੁਸੀਂ ਇਹ ਗੂਗਲ ਪੇ ਦੇ ਥਰੂਅ ਹੀ ਮੈਨੂੰ ਰੀਫੰਡ ਕਰੋਂਗੇ ਜਾਂ ਮੇਰੇ ਅਕਾਊਂਟ ਨੰਬਰ ਦੇ ਥਰੂਅ ਕਰੋਂਗੇ ਫਿਰ ਤੁਸੀਂ ਜਿਹੜਾ ਜੀ ਸਾਈਟ ਜੀ ਸਾਈਟ ਜੁ ਪੀ ਆਈ ਆਈ ਡੀ ਤੋਂ ਮੈਂ ਤੂਹਾਨੂੰ ਪੇਮੈਂਟ ਕੀਤੀ ਸੀ ਗੂਗਲ ਪੇ ਦੇ ਥਰੂਅ ਤੁਸੀਂ ਉਸੇ ਯੂ ਪੀ ਆਈ ਆਈ ਡੀ ਦੇ ਥਰੂਅ ਮੈਨੂੰ ਮੇਰੀ ਮੈਨੂੰ ਰੀਫੰਡ ਕਰ ਦਿਓ ਹਾਂਜੀ ਥੈਂਕ ਯੂ